ਰੋਪੜ ਵਰਗੇ ਖੇਤਰ ਦੇ ਵਿੱਚ ਕੈਂਸਰ ਵਰਗੀ ਵੱਡੀ ਬਿਮਾਰੀ ਦੇ ਲਈ ਇਲਾਜ ਅਤੇ ਸਹੂਲਤਾਂ ਨਹੀਂ ਹਨ ਅਤੇ ਜਿਸ ਕਰਕੇ ਸਾਨੂੰ ਵੱਡਿਆਂ ਸ਼ਹਿਰਾਂ ਵਧੇਰੇ ਚੰਡੀਗੜ੍ਹ ਦੇ ਵਿੱਚ ਜਾਣਾ ਪੈਂਦਾ ਹੈ ਜਿੱਥੇ ਕਿ ਕੀਮੋਥੇਰੈਪੀ ਨਾਂ ਦੀ ਜਿਹੜਾ ਪ੍ਰੋਸੈਸ ਹੈ ਉਹ ਚਾਲੂ ਹੁੰਦਾ ਹੈ ਲੇਕਿਨ ਜੇ ਅਸੀਂ ਗੱਲ ਕਰੀ ਡਾਇਲਾਸਿਸ ਦੀ ਅਤੇ ਫਿਜ਼ੀਓਥੈਰੇਪੀ ਦੀ ਤਾਂ ਉਨ੍ਹਾਂ ਦੇ ਲਈ ਜਿੰਦਲ ਹਸਪਤਾਲ ਪਰਮਾਰ ਹਸਪਤਾਲ ਅਤੇ ਜਿਹੜੇ ਸਰਕਾਰੀ ਹਸਪਤਾਲ ਨੇ ਉਹ ਅਵੇਲੇਵਲ ਹਨ ਅਤੇ ਹਾਂਜੀ ਜੇ ਅਸੀਂ ਉਹਨਾਂ ਕੋਲ ਪਹੁੰਚਣਾ ਚਾਹੀਏ ਤਾਂ ਉਹ ਪਹੁੰਚਣ ਯੋਗ ਵੀ ਹਨ ਅਤੇ ਕਿਫਾਇਤੀ ਵੀ ਹਨ